ਪੰਜਾਬ ਦੇ ਜ਼ਿਲ੍ਹੇ ਪਟਿਆਲੇ ਵਿੱਚ ਕਾਫੀ ਸਾਰੀਆਂ ਮੰਨੋਰੰਜਨ ਦੀਆਂ ਗਤੀਵਿਧੀਆਂ ਹੁੰਦੀਆਂ ਹੀ ਰਹਿੰਦੀਆਂ ਹਨ ਹਲੇ ਥੋੜ੍ਹੇ ਦਿਨ ਪਹਿਲਾਂ ਹੀ ਪਟਿਆਲੇ ਵਿੱਚ ਇੱਕ ਕਰਾਫਟ ਮੇਲਾ ਲੱਗਿਆ ਸੀ ਇਸ ਵੀ ਇਸ ਦੀ ਟਿਕਟ ਵੀਹ ਰੁਪਏ ਸੀਗੀ ਅਤੇ ਇਸਦੇ ਅੰਦਰ ਕਾਫੀ ਸਾਰੀਆਂ ਖਾਣ ਦੀਆਂ ਚੀਜ਼ਾਂ ਸੀ ਜਿਸ ਨੂੰ ਅਸੀਂ ਖਰੀਦ ਕੇ ਖਾ ਸਕਦੇ ਸੀਗੇ ਅਤੇ ਇਸ ਵਿੱਚ ਕਾਫੀ ਸਾਰੇ ਹੈਂਡਮੇਡ ਵੀ ਚੀਜ਼ਾਂ ਸੀ ਜਿਸਨੂੰ ਅਸੀਂ ਖਰੀਦ ਕੇ ਲਿਜਾ ਸਕਦੇ ਸੀ ਅਤੇ ਆਪਣੇ ਘਰ ਨੂੰ ਵਧੀਆ ਸਜਾ ਸਕਦੇ ਸੀ ਇਹਨਾਂ ਚੀਜ਼ਾਂ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਸੀ ਅਤੇ ਐਂਟਿਕ ਲੱਗਦੀਆਂ ਸੀ ਕਿਉਂਕਿ ਇਹ ਹੈਂਡਮੇਡ ਸੀਗੀਆਂ ਅਤੇ ਹੱਥਾਂ ਨਾਲ ਬਣਾਈਆ ਗਈਆਂ ਸੀ ਅਤੇ ਪੰਜਾਬ ਵਿੱਚ ਕਾਫੀ ਸਾਰੇ ਵਧੀਆ ਗਤੀਵਿਧੀਆਂ ਹੁੰਦੀਆਂ ਹੀ ਰਹਿੰਦੀਆਂ ਹਨ ਅਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈ ਕਿਉਂਕਿ ਇਹਨਾਂ ਵਿੱਚ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਕਾਫੀ ਕੁਛ ਸਾਨੂੰ ਅਸੀਂ ਇੱਥੋਂ ਸਿੱਖਦੇ ਹਾਂ ਕਿ ਕਿਵੇਂ ਆਪਾਂ ਨੂੰ ਕੀ ਚੀਜ਼ ਕਰਨੀ ਚਾਹੀਦੀ ਹੈ ਹੈਂਡਮੇਡ ਪ੍ਰੋਡਕਟਸ ਕਿਵੇਂ ਬਣਾ ਸਕਦੇ ਹਾਂ ਅਤੇ ਇਹ ਬਹੁਤ ਹੀ ਵਧੀਆ ਹੁੰਦਾ ਹੈ ਮੈਂ ਮੈਨੂੰ ਲੱਗਦਾ ਹੈ ਕਿ ਸਾਰਿਆ ਨੂੰ ਇਹੇ ਜਿਹੇ ਮੇਲਿਆਂ 'ਤੇ ਜਾਣਾ ਚਾਹੀਦਾ ਹੈ ਕਿਉਂਕਿ ਇਸ ਇੱਥੋਂ ਅਸੀਂ ਬਹੁਤ ਹੀ ਜ਼ਿਆਦਾ ਸ ਕੁਝ ਸਿੱਖ ਸਕਦੇ ਹਾਂ ਅਤੇ ਕਾਫੀ ਚੀਜ਼ਾਂ ਇੱਥੋਂ ਸਿੱਖਣ ਨੂੰ ਮਿਲਦੀਆਂ ਨੇ ਅਸੀਂ ਇੱਥੇ ਇੱਥੇ ਇਹ ਉਪਲਬਧੀ ਵੀ ਮੌਜੂਦ ਹੁੰਦੀ ਹੈ ਕਿ ਅਸੀਂ ਉੱਥੇ ਚੀਜ਼ ਬੈਠ ਕੇ ਬਣਾ ਸਕਦੇ ਹਾਂ ਕਈ ਕਈ ਇੱਥੇ ਸ਼ੋਪਸ ਹੁੰਦੀਆਂ ਨੇ ਜਿਹੜੀਆਂ ਕਿ ਸਾਨੂੰ ਦੱਸਦੀਆਂ ਨੇ ਅਸੀਂ ਆਹ ਚੀਜ਼ ਐਵੇਂ ਬਣਾਉਣੀ ਹੈ ਅਤੇ ਅਸੀਂ ਉੱਥੇ ਬੈਠ ਕੇ ਖੁਦ ਆਪਣਾ ਕੁਝ ਵੀ ਹੈਂਡਮੇਡ ਚੀਜ਼ ਬਣਾ ਲੈਂਦੇ ਹਾਂ ਜਿਵੇਂ ਕਿ ਮੈਨੇ ਉੱਥੇ ਬੈਠ ਕੇ ਆਪਣਾ ਬਰੈਸਲੇਟ ਬਣਾਇਆ ਸੀਗਾ ਅਤੇ ਓਹਨਾਂ ਕੋਲ ਉਸ ਦਾ ਸਮਾ ਸਾਰਾ ਸਮਾਨ ਉਪਲੱ ਉਪਲਬਧ ਸੀ ਓਹ ਮੈਨੂੰ ਦੱਸੀ ਜਾ ਰਹੇ ਸੀ ਕੀ ਕੀ ਚੀਜ਼ ਕਿਵੇਂ ਬਣਾਉਣੀ ਹੈ ਅਤੇ ਮੈਂ ਓਸੇ ਟਾਈਪ ਹੀ ਸਟੈੱਪ ਬਾਏ ਸਟੈੱਪ ਫੋਲੋ ਕਰਦੀ ਗਈ ਅਤੇ ਮੈਂ ਆਪਣਾ ਬਹੁਤ ਜ਼ਿਆਦਾ ਵਧੀਆ ਬਰੈਸਲੇਟ ਬਣਾ ਲਿਆ ਅਤੇ ਓਹ ਇੰਨਾਂ ਵਧੀਆ ਤਾਂ ਨਹੀਂ ਬਣਿਆ ਸੀ ਪਰ ਇਹ ਮੇਰੀ ਪਹਿਲੀ ਕੋਸ਼ਿਸ਼ ਸੀ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਅਤੇ ਮੈਨੇ ਬਹੁਤ ਹੀ ਜ਼ਿਆਦਾ ਇੰਨਜੋਆਏ ਕੀਤਾ